ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ

ਅੱਛਾ ਜੀ ਕੋਈ ਨਹੀਂ ਕਰਵਾ ਦਾਂਗੇ ਜੀ ਹਾਂਜੀ ਹਾਂਜੀ ਹਾਂ ਉਹ ਮੋਬਾਇਲਾਂ ਦਾ ਬਹੁਤ ਬੁਰਾ ਹਾਲ ਕਰ ਛੱਡਿਆ ਬੱਚਿਆਂ ਦਾ ਜੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਨਾ ਇੱਧਰ ਗੇਮ ਜਿਹੜੇ ਆਪਣੇ ਮਤਲਬ ਵੀ ਕਬੱਡੀ ਹੋ ਗਈ ਬਾਸਕਿਟਬਾਲ ਹੋ ਗਈ ਜਿਵੇਂ ਅਤੇ ਹੋਰ ਆਪਣੇ ਜਿਹੜੀਆਂ ਮਤਲਬ ਕਿ ਹੋਰ ਵੀ ਗੇਮਾਂ ਸਾਰੀਆਂ ਸਾਰੀਆਂ ਗੇਮਾਂ ਹੀ ਕਰਵਾਉਂਦੇ ਆਪਾਂ ਹਾਂ ਵਾਲੀਬਾਲ ਹੋ ਗਈ ਜਿਸ ਤਰ੍ਹਾਂ ਇਹਦੀ ਆਪਣੀ ਹੈਗੀ ਚਾਰ ਹਜ਼ਾਰ ਰੁਪਈਆ ਫ਼ੀਸ ਆ ਜੀ ਮਹੀਨੇ ਦੀ ਹੂੰ ਹੂੰ ਸਵਰੇ ਅੱਠ ਤੋਂ ਮਤਲਬ ਕਿ ਜੀ ਦੋ ਵਜੇ ਤੱਕ ਹਾਂ ਹਾਂ ਗਰਮੀ ਦੇ ਉਹਦੇ ਕਰਕੇ ਨਾ ਬੱਚੇ ਨੂੰ ਜਲਦੀ ਹੁੰਦਾ ਨਹੀਂ ਤਾਂ ਚਾਰ ਵਜੇ ਤੱਕਰ ਹੁੰਦਾ

ਨਹੀਂ ਨਹੀਂ ਇਹ ਤਾਂ ਵਧੀਆ ਸੋਚ ਹੈ ਜੀ ਤੁਹਾਡੀ ਨਾ ਗੇਮਾਂ ਦੇ ਵਿੱਚ ਬੱਚੇ ਨੂੰ ਅਗਾਂਹ ਲੈ ਕੇ ਹਾਂ ਹਾਂ ਬੱਚਿਆਂ ਦੀ ਅਗਾਂਹ ਫਿਰ ਵੀ ਤਰੱਕੀ ਹੁੰਦੀ ਆ ਕਿ ਨਹੀਂ ਫਿਰ ਵੀ ਬੱਚਾ ਕੋਈ ਵੀ ਗੇਮ ਫੜ ਲੇ ਨਾ ਬੱਚੇ ਦੀ ਅਗਾਂਹਾਂ ਜ਼ਿੰਦਗੀ ਬਣ ਜਾਂਦੀ ਉਹਦੇ ਕਰਕੇ ਨਾ ਬਹੁਤ ਵਧੀਆ ਸਮਕੀ ਤੁਹਾਡੀ ਸੋਚ ਵਧੀਆ ਦੇਖੋ ਬੱਚੇ ਨੂੰ ਅਗਾਹਾਂ ਅੱਗੇ ਪੜ੍ਹਾਓ ਗੇਮਾਂ ਕਰਾਵਾਓ ਵਧੀਆ ਫਿਰ ਹੀ ਬੱਚੇ ਦਾ ਮਤਲਬ ਕਿ ਮਾਂ ਪਿਓ ਦਾ ਨਾਂ ਰੋਸ਼ਨ ਕਰਦਾ ਬੱਚਾ ਠੀਕ ਹੈ ਹੂ ਹਾਂ ਹਾਂ ਉਹ ਵੀ ਕਰਵਾਉਂਦੇ ਜੀ ਹਾਂ ਹਾਂ ਟੂਰਨਾਮੈਂਟ ਕਰਵਾਉਂਦੇ ਹਾਂ ਹਾਂ ਹਾਂ ਉਹ ਸਾਰੇ ਚਾਹੀਦੇ ਆ ਸਾਰੇ ਡਾਕੂਮੈਂਟ ਲੈਂਦੇ ਹਾਂ ਨਾ ਹਾਂ ਹਾਂ ਠੀਕ ਹੈ ਕੋਈ ਗੱਲ ਨਹੀਂ ਲੈ ਆਇਓ ਕਰਵਾ ਦਾਂਗੇ ਜਰੂਰ ਠੀਕ ਹੈ ਹਾਂ ਨਹੀਂ ਨਹੀਂ ਕੋਈ ਨਹੀਂ ਵਧੀਆ ਕਰਵਾਵਾਂਗੇ ਠੀਕ ਹੈ ਸਾਨੂੰ ਤਾਂ ਐਂ ਸੀ ਵਧੀਆ ਹੋਊਗੀ ਚੀਜ਼ ਅਤੇ ਫਿਰ ਹੀ ਅਗਾਂਹਾਂ ਸਾਡੇ ਤਾਂ ਨਾਂ ਰੌਸ਼ਨ ਹੋਊਗਾ ਠੀਕ ਹੈ ਅਗਾਂਹ ਫਿਰ ਹੀ ਸਾਡੇ ਵੱਧਣਗੇ ਫਿਰ ਹੀ ਸਾਡੇ ਤਾਂ ਵੱਧ ਤੋਂ ਵੱਧ ਬੱਚੇ ਭਰਤੀ ਹੋਣਗੇ ਇੱਥੇ

ਕੋਈ ਗੱਲ ਨਹੀਂ ਤੁਸੀਂ ਲਿਆਇਓ ਠੀਕ ਹੈ ਕਰਵਾ ਦੇਗੇ ਠੀਕ ਹੈ ਹਾਂ ਹਾਂ ਇੱਕ ਤਰੀਕ ਤੋਂ ਸ਼ੁਰੂ ਆ ਜੀ ਬਸ

ਠੀਕ ਹੈ ਜੀ ਓਕੇ ਜੀ ਓਕੇ ਜੀ